ਆਮ ਤੌਰ 'ਤੇ ਸਹਿਮਤੀ ਹੈ ਕਿ ਭਾਸ਼ਾ ਦੀ ਅਸਲੀ ਲਿਖਤ ਨਾ ਦੀ ਘੱਟੋ ਘੱਟ ਪ੍ਰਾਚੀਨ ਸੱਭਿਅਤਾ ਵਿੱਚ ਸੁਤੰਤਰ ਤੌਰ 'ਤੇ ਕਾਢ ਅਤੇ ਵਿਕਾਸ ਹੋਇਆ ਸੀ ਦੋ ਥਾਵਾਂ ਜਿੱਥੇ ਇਹ ਸਭ ਤੋਂ ਜ਼ਿਆਦਾ ਇਹ ਨਿਸ਼ਚਿਤ ਹੈ ਕਿ ਲੇਖ ਲਿਖਣ ਦੀ ਕਾਢ ਸੁਤੰਤਰ ਤੌਰ 'ਤੇ ਹੋਈ ਹੈ ਹੋਈ ਅਤੇ ਲਿਖਣ ਪ੍ਰਣਾਲੀ ਵਿਕਸਿਤ ਕੀਤੀ ਗਈ ਸੀ ਉਹ ਪੁਰਾਤਨ ਸੁਮੇਰ ਕਰੀਬ ਇਕੱਤੀ ਸੌ ਈਸਵੀ ਪੂਰਵ ਵਿੱਚ ਉਹ ਮੈਸੋਅਮੈਰੀਕਾ ਤਿੰਨ ਸੌ ਈਸਵੀ ਪੂਰਬ ਵਿੱਚ ਕਿਉਂਕਿ ਇਹਨਾਂ ਵਿੱਚੋਂ ਕਿਸੇ ਵਿੱਚ ਇਸ ਤੋਂ ਪੁਰਾਣਾ ਕੋਈ ਵੀ ਖੁਰਾ ਖੋਜ ਲੱਭਿਆ ਨਹੀਂ ਹੈ ਕਈ ਮੈਸੋਅਮੈਰੀਕੀ ਲਿਪੀਆਂ ਜਾਣੀਆਂ ਜਾਂਦੀਆਂ ਹਨ ਸਭ ਤੋਂ ਪੁਰਾਣੀ ਮੈਕਸਿਕੋ ਅਤੇ ਉਲਮੇਕ ਚਾਹ ਜਾਪੋ ਟੈਕ ਤੋਂ ਵੀ ਹੈ ਆਜ਼ਾਦ ਲਿਖਣ ਪ੍ਰਣਾਲੀਆਂ ਇਕੱਤੀ ਸੌ ਈਪੂ ਨੂੰ ਨੇੜੇ ਮਿਸਰ ਵਿੱਚ ਅਤੇ ਚੀਨ ਵਿੱਚ ਲਗਭਗ ਬਾਰਾਂ ਸੌ ਈਸਵੀ ਈਪੂ ਵਿੱਚ ਰੂਪ ਰੂਪਮਾਨ ਹੋਇਆ ਪਰ ਇਤਿਹਾਸਕਾਰ ਵਿੱਚ ਇਤਿਹਾਸਕਾਰ ਵਿੱਚ ਇਸ ਗੱਲ ਦਾ ਬਹਿਸ ਕਰਦੇ ਹਨ ਕਿ ਇਹ ਲਿਖੀਆਂ ਲਿਖਾਈ ਪ੍ਰਣਾਲੀ ਸੁਮੇਰੀ ਲਿਖਾਈ ਤੋਂ ਪੂਰੀ ਤਰ੍ਹਾਂ ਸੁਤੰਤਰ ਰੂਪ ਵਿੱਚ ਵਿਕਸਿਤ ਹੈ